ਹੈਲੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ

ਹਮ ਹਾਂਜੀ ਉਹਦੇ ਨਾ ਸੈਵਨਟੀ ਫਾਈਵ ਪ੍ਰਸੈਂਟ ਆਪਣੇ ਪਲਸ ਟੂ ਦੇ ਵਿੱਚ ਨੰਬਰ ਹੋਣੇ ਚਾਹੀਦੇ ਨੇ ਸੈਵਨਟੀ ਫਾਈਵ ਜਾਂ ਉਹ ਤੋਂ ਵੱਧ ਹੋਣ ਅਤੇ ਉਸ ਤੋਂ ਇਲਾਵਾ ਆਪਣੇ ਕੋਲ ਐਸੀ ਕੈਟੇਗਰੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਅਤੇ ਜਿਹੜੀ ਆਪਣੀ ਸਲਾਨਾ ਇਨਕਮ ਹੈ ਘਰ ਦੀ ਫੈਮਿਲੀ ਇਨਕਮ ਹੈ ਉਹ ਇਕ ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਹਦਾ ਵੀ ਹੈ ਜਿਹੜਾ ਉਹ ਐਫੀਡੈਵੀਟ ਹੈ ਬਣਵਾਇਆ ਹੋਣਾ ਚਾਹੀਦਾ ਇਹ ਤਿੰਨ ਡਾਕੂਮੈਂਟ ਨੇ ਜਿਹੜੇ ਲੱਗਣਗੇ ਉਹਨਾਂ ਨੂੰ ਹੀ ਇਹ ਜਿਹੜੀ ਸਕਾਲਰਸ਼ਿਪ ਆ ਉਹ ਕਾਲਜ ਦੇ ਵੱਲੋਂ ਇਹ ਪ੍ਰੋਵਾਈਡ ਕੀਤੀ ਜਾਵੇਗੀ ਤੁਹਾਡੇ ਕੋਲ ਹੈਗੇ ਨੇ ਸਰਟੀਫਿਕੇਟ ਅੱਛਾ ਹਮ ਹਮ ਹਮ ਹਮ ਫਿਰ ਤੁਹਾਡੇ ਲਈ ਆਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵਾਲੀ ਤਾਂ ਨਹੀਂ ਤੁਹਾਡੇ ਲਈ ਹੋ ਸਕਦੀ ਸਕੋਲਰਸ਼ਿਪ ਫਿਰ ਇੱਕ ਤੁਹਾਡੇ ਲਈ ਨਾ ਮ ਮੌਲਾਨਾ ਆਜ਼ਾਦੀ ਦੀ ਸਕਾਲਰਸ਼ਿਪ ਹੈ ਉਹਦੇ ਵਿੱਚ ਹਰ ਇੱਕ ਬੱਚਾ ਜਿਹੜਾ ਉਹ ਜੁਆਇਨ ਕਰ ਸਕਦਾ ਜੇ ਬੇਸ਼ੱਕ ਪ੍ਰਾਈਵੇਟ ਜੋਬ ਹੈ ਜੇ ਉਹਨਾਂ ਦੇ ਪੇਰੈਂਟਸ ਵੀ ਚਾਹੇ ਉਹਨਾਂ ਦੀ ਗੌਰਮੈਂਟ ਜੋਬ ਹੈ ਬਸ ਉਹਦੇ 'ਚ ਪ੍ਰਸੈਂਟੇਜ ਹੈ ਜਿਹੜੀ ਉਹ ਏਟੀ ਪਲੱਸ ਚਾਹੀਦੀ ਆ ਇਹਦੇ ਵਿੱਚ ਸਿਰਫ ਆਪਣੀ ਕੈਟੇਗਰੀ ਦਾ ਸਰਟੀਫਿਕੇਟ ਲੱਗੇਗਾ ਅਤੇ ਇਨਕਮ ਸਰਟੀਫਿਕੇਟ ਉਹੀ ਇਨਕਮ ਸਰਟੀਫਿਕੇਟ ਇਹਦੇ ਵਿੱਚ ਪੰਜ ਲੱਖ ਤੋਂ ਅਬਵ ਵੀ ਹੋਵੇ ਇਨਕਮ ਤਾਂ ਵੀ ਕੋਈ ਈਸ਼ੂ ਨਹੀਂ ਹੈਗਾ ਮੇਨ ਆਪਣਾ ਸਿਰਫ ਉਹਨਾਂ ਦਾ ਫੋਕਸ ਪ੍ਰਸੈਂਟੇਜ ਦੇ ਉੱਤੇ ਹੀ ਹੈਗਾ ਏਟੀ ਤੋਂ ਅਬਵ ਹੋਵੇ ਹਮ ਠੀਕ ਹੈ ਜੀ ਓਕੇ ਫਿਰ ਤੁਸੀਂ ਨਾ ਅਪਲਾਈ ਕਰ ਦਿਓ ਇਹ ਵੀਹ ਜਨਵਰੀ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਓਕੇ